ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਰੁਣਾ ਬੋਲ ਰਹੀ ਹਾਂ ਜੀ ਸਾਡੇ ਉੱਤੇ ਇਹ ਬ੍ਰਾਹਿਮੰਡ ਸਾਰੇ ਉੱਤੇ ਵੀ ਚੰਦਰਮਾ ਗ੍ਰਹਿ ਚੰਦਰਮਾ ਸ ਸੂਰਜ ਤਾਰੇ ਉਹੀ ਦਿਸਦੇ ਆ ਉੱਥੇ ਹੋਰ ਕੁਛ ਨਹੀਂ ਹੈ ਅਤੇ ਬਾਕੀ ਜ਼ਿਆਦਾ ਮੈਨੂੰ ਨੋਲਿਜ ਨਹੀਂ ਹੈ ਕਿਉਂਕਿ ਅਸੀਂ ਕਿੰਨਾ ਜ਼ਿਆਦਾ ਨਹੀਂ ਜਾਣਦੇ ਇਸ ਬਾਰੇ ਇੱਥੇ ਇਹ ਵਾ ਕਿੰਨਾ ਨੇ ਉਹਨਾਂ ਨੇ ਚ ਨੌਂ ਗ੍ਰਹਿ ਘੁੰਮਦੇ ਆ ਨੌਂ ਗ੍ਰਹਿ ਘੁੰਮਦੇ ਆ ਉੱਥੇ ਅਤੇ ਇਹ ਵਾ ਸਾਡੇ ਭਾ ਭਾਰਤ ਨੇ ਵੀ ਭੇਜਿਆ ਸੀ ਉਹ ਚੰਦਰਮਾ ਅਤੇ ਅਤੇ ਚੰਦਰਆਣ ਅਤੇ ਉਹ ਉਹਨਾਂ ਨੇ ਕਿਹਾ ਵੀ ਉੱਥੇ ਹਵਾ ਪਾਣੀ ਅਤੇ ਆਕਸੀਜਨ ਹੈਗੀ ਆ ਪਰ ਉੱਥੇ ਰਿਹਾਇਸ਼ ਨਹੀਂ ਹੈਗੀ ਉੱਥੇ ਇਹ ਵਾ ਵੀ ਸਾਰੇ ਬਾਕੀ ਅਮੈਰੀਕਾ ਕਨੇਡਾ ਰੂਸ ਸਾਰੇ ਨੇ ਉਹ ਸਾਰਿਆਂ ਨੇ ਇਹੀ ਕਿ ਦੱਸਿਆ ਵੀ ਉੱਥੇ ਹਵਾ ਪਾਣੀ ਸੂਰਜ ਹੈ ਵਾ ਪਰ ਉੱਥੇ ਰਿਹਾਇਸ਼ ਹੈ ਨਹੀਂ ਉੱਥੇ ਰਹਿੰਦੇ ਕੋਈ ਨਹੀਂ ਹੈ ਬਾਕੀ ਜ਼ਿਆਦਾ ਨਹੀਂ ਜਾਣਦੀ ਮੈਂ